ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਮੈਂ ਰਹਿਣ ਵਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਹਾਂ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਅਤੇ ਪੰਜਾਬੀ ਲੈਂਗੁਏਜ ਮੇਰੀ ਮਾਂ ਬੋਲੀ ਹੈ ਜਨਮ ਤੋਂ ਲੈ ਕੇ ਹੁਣ ਤੱਕ ਮੈਂ ਪੰਜਾਬੀ ਬੋਲੀ ਹੀ ਬੋਲਦਾ ਆਇਆ ਹਾਂ ਅਤੇ ਸਿੱਖਦਾ ਆਇਆ ਹਾਂ ਪੰਜਾਬੀ ਹਰ ਕਿਸੇ ਨੂੰ ਪੰਜਾਬੀ ਬੋਲੀ ਦਾ ਇਹ ਮਾਣ ਮਾਣ ਹੈ ਅਤੇ ਮਾਣ ਕਰਨਾ ਵੀ ਚਾਹੀਦਾ ਹੈ ਅਸੀਂ ਜਿਸ ਵੀ ਬੰਦੇ ਨਾਲ ਪੰਜਾਬੀ ਬੰਦੇ ਜਿਸ ਵੀ ਬੰਦੇ ਨੂੰ ਬੁਲਾਉਂਦੇ ਹਨ ਹੱਸ ਕੇ ਬੁਲਾਉਂਦੇ ਹਨ ਅਤੇ ਪੰਜਾਬੀ ਭਾਸ਼ਾ ਵਿੱਚ ਬਹੁਤ ਹੀ ਪਿਆਰ ਛੁਪਿਆ ਹੋਇਆ ਹੈ ਬਹੁਤ ਹੀ ਸਤਿਕਾਰ ਛੁਪਿਆ ਹੋਇਆ ਹੈ ਅਸੀਂ ਸਾਰਿਆਂ ਨੂੰ ਸਤਿਕਾਰ ਨਾਲ ਬੁਲਾਉਂਦੇ ਹਾਂ ਅਤੇ ਰਲ ਮਿਲ ਕੇ ਪੰਜਾਬ ਦੇ ਜਿੰਨੇ ਵੀ ਬੰਦੇ ਨੇ ਰਲ ਮਿਲ ਕੇ ਇੱਕ ਦੂਸਰੇ ਨਾਲ ਪਿਆਰ ਰੱਖਦੇ ਹਨ ਅਤੇ ਅਸੀਂ ਦੇਸ਼ ਵਿੱਚ ਕਿਤੇ ਵੀ ਚਲ ਜਾਈਏ ਪੰਜਾਬੀ ਭਾਸ਼ਾ ਦਾ ਹਰ ਜਗ੍ਹਾ 'ਤੇ ਸਤਿਕਾਰ ਹੁੰਦਾ ਹੈ ਸਾਡੇ ਇੱਕ ਪਾਸੇ ਹਿਮਾਚਲ ਬੋਲੀ ਲੱਗਦੀ ਹੈ ਇੱਕ ਪਾਸੇ ਡੋਗਰੀ ਲੱਗਦੀ ਹੈ ਪਰ ਸਾਨੂੰ ਪੰਜਾਬੀ ਭਾਸ਼ਾ ਬਹੁਤ ਮਿੱਠੀ ਲੱਗਦੀ ਹੈ ਅਤੇ ਇਸ ਵਿੱਚ ਸੱਚ ਵਿੱਚ ਹੀ ਬੜੀ ਮਿਠਾਸ ਹੈ ਇਸ ਕਰਕੇ ਜਦੋਂ ਵੀ ਮੈਂ ਕਿਤੇ ਵੀ ਬਾਹਰ ਜਾਂਦਾ ਹਾਂ ਅਤੇ ਆਪਣੀ ਪੰਜਾਬੀ ਬੋਲੀ ਆਪਣੀ ਮਾਂ ਬੋਲੀ ਨੂੰ ਮਾਂ ਬੋਲੀ ਨਾਲ ਵਿੱਚ ਹੀ ਗੱਲ ਕਰਦਾ ਹਾਂ ਅਤੇ ਮੈਨੂੰ ਆਪਣੇ ਪੰਜਾਬ ਅਤੇ ਆਪਣੀ ਪੰਜਾਬੀ ਮਾਂ ਬੋਲੀ 'ਤੇ ਬਹੁਤ ਹੀ ਜ਼ਿਆਦਾ ਮਾਣ ਹੈ ਮੈਂ ਬਹੁਤ ਮੈਂ ਬਹੁਤ ਸੁਭਾਗਾਂ ਵਾਲੀ ਹਾਂ ਕਿ ਜਿਹੜਾ ਮੇਰਾ ਪੰਜਾਬ ਵਿੱਚ ਜਨਮ ਹੋਇਆ